ਖਾਣਾ ਬਣਾਉਣ ਵਾਸਤੇ ਸਾਨੂੰ ਕਈ ਟੂਲਾਂ ਦੀ ਲੋੜ ਦੀ ਜ਼ਰੂਰਤ ਪੈ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਅਲੱਗ ਅਲੱਗ ਕੈਟਾਗੀਰੀਜ ਦੇ ਟੂਲ ਆਉਂਦੇ ਹੈ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਤਾਂ ਸਾਨੂੰ ਸਲੰਡਰ ਚਾਹੀਦਾ ਆ ਚੁੱਲ੍ਹਾ ਚਾਹੀਦਾ ਆ ਜੋ ਕਿ ਸਾਨੂੰ ਅੱਗ ਅੱਗ ਬਾਲਣ ਦੇ ਵਿੱਚ ਹੈਲਪ ਕਰਦਾ ਹੈ ਫਿਰ ਉਸ ਤੋਂ ਬਾਅਦ ਸਾਨੂੰ ਕੜਾਹੀ ਚਾਹੀਦੀ ਹੈ ਕੜਛੀ ਚਾਹੀਦੀ ਆ ਨਮਕ ਦਾਣੀ ਚਾਹੀਦੀ ਆ ਕੁਛ ਸਬਜ਼ੀਆਂ ਚਾਹੀਦੀਆਂ ਨੇ ਜਿਨ੍ਹਾਂ ਨੂੰ ਆਪਾਂ ਕੱਟ ਕਰਨ ਲਈ ਕਟਰ ਚੋਪਿੰਗ ਬੋਰਡ ਚਾਹੀਦਾ ਨੇ ਚਾਕੂ ਚਾਹੀਦਾ ਨੇ ਚੱਮਚ ਚਾਹੀਦਾ ਆ ਜਿਨ੍ਹਾਂ ਦੇ ਕਰਕੇ ਆਪਾਂ ਸਬਜ਼ੀ ਬਣਾ ਸਕੀਏ ਉਨ੍ਹਾਂ ਦੇ ਵਿੱਚ ਅਗਰ ਖਾਣ ਵਾਸਤੇ ਵੀ ਸਾਨੂੰ ਚਾਹੀਏ ਤਾਂ ਕਈ ਚੀਜ਼ਾਂ ਆ ਜਾਂਦੀਆਂ ਜਿੱਦਾਂ ਪਲੇਟ ਆ ਜਾਂਦੀ ਆ ਚੱਮਚ ਆ ਜਾਂਦਾ ਆ ਅਤੇ ਹੋਰ ਕੜਛੀ ਆ ਜਾਂਦੀ ਆ ਅਤੇ ਕਈ ਇੱਦਾਂ ਦੇ ਟੂਲਸ ਹੈਗੇ ਨੇ ਜਿਨ੍ਹਾਂ ਵਿੱਚ ਜਿਨ੍ਹਾਂ ਦੀ ਵਰਤੋਂ ਨਹੀਂ ਹੋਵੇ ਤਾਂ ਸਾਡਾ ਖਾਣਾ ਨਹੀਂ ਬਣ ਸਕਦਾ ਲਾਈਕ ਕੜਾਹੀ ਹੋ ਗਈ ਕੂੱਕਰ ਹੋ ਗਿਆ ਪਤੀਲਾ ਹੋ ਗਿਆ ਇਨ੍ਹਾਂ ਸਾਰਿਆਂ ਦੀ ਸਾਨੂੰ ਵਰਤੋਂ ਕਰਨੀ ਜ਼ਰੂਰੀ ਹੈ ਇਨ੍ਹਾਂ ਦੇ ਬਿਨਾਂ ਸਬਜ਼ੀ ਨਹੀਂ ਬਣ ਸਕਦੀ